ਅਠਾਈ ਜਨਵਰੀ ਉੱਨੀ ਸੌ ਪੰਝੱਤਰ ਪੰਦਰਾਂ ਜੁਲਾਈ ਉੱਨੀ ਸੌ ਸਤੱਤਰ ਇੱਕ ਸਤੰਬਰ ਉੱਨੀ ਸੌ ਸਤੱਤਰ ਬਾਰਾਂ ਸਤੰਬਰ ਉੱਨੀ ਸੌ ਅੱਸੀ ਚਾਰ ਸਤੰਬਰ ਦੋ ਹਜ਼ਾਰ ਤਿੰਨ ਬਾਈ ਮਈ ਦੋ ਹਜ਼ਾਰ ਇੱਕ